ਅਸੀਂ ਪੌਦਿਆਂ ਲਈ ਗਰਮੀਆਂ ਦੇ ਵਿੱਚ ਉਹਨਾਂ ਦਾ ਪਾਣੀ ਦਾ ਹਿਸਾਬ ਦੇਖਦੇ ਹਾਂ ਜਦੋਂ ਵੀ ਜ਼ਮੀਨ ਜ਼ਿਆਦਾ ਖੁਸ਼ਕ ਹੋਣ ਲੱਗਦੀ ਹੈ ਤਾਂ ਅਸੀਂ ਉਹਨਾਂ ਨੂੰ ਪਾਣੀ ਦਿੰਦੇ ਹਾਂ ਅਤੇ ਜਦੋਂ ਸਿਆਲ ਦੀ ਰੁੱਤ ਆ ਜਾਂਦੀ ਹੈ ਉਦੋਂ ਠੰਢ ਬਹੁਤ ਹੋ ਜਾਂਦੀ ਹੈ ਉਦੋਂ ਅਈ ਅਸੀਂ ਇਹਨਾਂ ਨੂੰ ਪਾਣੀ ਘੱਟ ਲਾਉਂਦੇ ਹਾਂ ਅਤੇ ਜਿਹੜੇ ਦਰਖਤ ਜਿਹੜੇ ਪੌਦੇ ਠੰਢ ਤੋਂ ਠੰਢ ਦੇ ਨਾਲ ਸੜ ਜਾਂਦੇ ਆ ਉਹਨਾਂ ਵਾਸਤੇ ਅਸੀਂ ਉਹਨਾਂ ਦੇ ਉੱਪਰ ਛਾਂ ਕਰਦੇ ਹਾਂ ਅਤੇ ਓ ਉਹ ਕਿਉਂਕਿ ਉਹ ਸੜ ਨਾ ਜਾਣ ਅਤੇ ਉਹਨਾਂ ਨੂੰ ਜਿਹੜੀ ਦਵਾਈ ਹੈ ਉਹ ਵੀ ਸਮੇਂ ਦੇ ਅਨੁਸਾਰ ਹੀ ਪਾਉਂਦੇ ਹਾਂ ਜਦੋਂ ਕਿਤੇ ਲੋੜ ਪੈਂਦੀ ਹੈ ਕਿ ਬੂਟਾ ਵੱਧ ਨਹੀਂ ਰਿਹਾ ਤਾਂ ਫਿਰ ਅਸੀਂ ਉਹਨਾਂ ਨੂੰ ਗੋਹੇ ਦੀ ਰੂੜੀ ਪਾ ਕੇ ਅਤੇ ਉਹਨਾਂ ਨੂੰ ਨਾਲ ਥੋੜ੍ਹੀ ਖਾਦ ਵੀ ਪਾਉਂਦੇ ਹਾਂ ਅਤੇ ਜਦੋਂ ਬੂਟਾ ਚੰਗਾ ਫਲ ਦੇਣ ਲੱਗ ਜਾਂਦਾ ਹੈ ਫਿਰ ਅਸੀਂ ਉਹਦੇ ਆਲੇ ਦੁਆਲੇ ਦਾ ਧਿਆਨ ਰੱਖਦੇ ਹਾਂ ਕਿ ਕੋਈ ਵੀ ਹੋਰ ਇਹਦੇ ਵਿੱਚ ਕੀੜਾ ਹਮਲਾ ਨਾ ਕਰੇ ਜਦੋਂ ਕੀੜੇ ਹਮਲੇ ਕਰਦੇ ਆ ਉਦੋਂ ਜਿਹੜੇ ਫਲ ਆ ਉਹ ਖਰਾਬ ਹੋ ਜਾਂਦੇ ਆ ਇਸ ਕਰਕੇ ਸਾਨੂੰ ਕਾਫੀ ਇਹਦਾ ਧਿਆਨ ਰੱਖਣਾ ਪੈਂਦਾ ਹੈ